ਹਾਂਜੀ ਮੈਂ ਮਾਸਟਰ ਸਲੀਮ ਨੂੰ ਲਾਈਵ ਸੁਣਿਆ ਹੈ ਜੋ ਇੱਕ ਭਜ ਜਗਰਾਤੇ ਵਿੱਚ ਆਏ ਸੀ ਔਰ ਉਹਨਾਂ ਨੇ ਬਹੁਤ ਅੱਛੀਆਂ ਮਾਤਾ ਦੀਆਂ ਭੇਟਾਂ ਗਾਈਆਂ ਜੋ ਬਹੁਤ ਅੱਛੀਆਂ ਲੱਗੀਆਂ ਦਿਲ ਲੱਗਿਆ ਉਹਨਾਂ ਦੀਆਂ ਭੇਟਾਂ ਨਾਲ ਪੂਰੀ ਰਾਤ ਪਤਾ ਹੀ ਨੀ ਲੱਗਿਆ ਕਿ ਜਗਰਾਤਾ ਕਦ ਸ਼ੁਰੂ ਹੋਇਆ ਔਰ ਕਦ ਖਤਮ ਹੋ ਗਿਆ ਔਰ ਮਾਤਾ ਦੀਆਂ ਭੇਟਾਂ ਉਹਨਾਂ ਨੇ ਐਨੀਆਂ ਅੱਛੀਆਂ ਗਾਈਆਂ ਕਿ ਬਹੁਤ ਜ਼ਿਆਦਾ ਭਗਤੀ ਵਾਲਾ ਪੂਰਾ ਮਾਹੌਲ ਬਣ ਗਿਆ ਉੱਥੇ ਔਰ ਬਹੁਤ ਅੱਛੀ ਫੀਲਿੰਗ ਆਈ ਔਰ ਉਹ ਬਹੁਤ ਅੱਛਾ ਗਾਉਂਦੇ ਨੇ